ਪੰਜਾਬ ਦੇ ਵਿੱਚ ਰਹਿਣ ਕਰਕੇ ਸਾਡਾ ਜਿਹੜਾ ਪਰਿਵਾਰਿਕ ਸੰਬੰਧ ਹੈ ਉਹ ਬਹੁਤ ਵੱਡੇ ਆ ਯਾਨੀ ਕਿ ਪਰਿਵਾਰਿਕ ਸਰਕਲ ਵੀ ਸਾਡਾ ਬਹੁਤ ਵੱਡਾ ਹੈਗਾ ਪਰ ਮੇਰਾ ਜਿਹੜਾ ਇੱਕ ਛੋਟਾ ਜਿਹਾ ਪਰਿਵਾਰ ਹੈ ਮੈਂ ਆਪਣੇ ਪਰਿਵਾਰ ਦੇ ਵਿੱਚ ਮੇਰੇ ਮੈਂ ਮੇਰੇ ਵਾਈਫ ਜਿਸ ਤਰ੍ਹਾਂ ਮੇਰਾ ਨਾਂ ਹਰਦੀਪ ਸਿੰਘ ਮੇਰੇ ਵਾਈਫ ਦਾ ਨਾਮ ਭੁਪਿੰਦਰ ਕੌਰ ਅਤੇ ਇੱਕ ਮੇਰਾ ਗਿਆਰ੍ਹਾਂ ਸਾਲ ਦਾ ਬੇਟਾ ਹੈ ਜਪਤੇਜ ਸਿੰਘ ਜਿਹੜਾ ਕਿ ਪੰਜਵੀਂ ਕਲਾਸ ਦੇ ਵਿੱਚ ਪੜ੍ਹਦਾ ਹੈ ਅਤੇ ਮੇਰੀ ਵਾਈਫ ਹਾਊਸਵਾਈਫ ਹੈ ਅਤੇ ਇਸੇ ਤਰ੍ਹਾਂ ਮੇਰੇ ਦੋ ਬ੍ਰਦ ਬ੍ਰਦਰ ਹੈ ਜੋ ਕਿ ਦੁ ਦੁਬਈ ਵਿਖੇ ਜੋਬ ਕਰਦਾ ਹੈ ਅਤੇ ਉਸ ਦੀ ਵੀ ਵਾਈਫ ਅਮਰਜੀਤ ਕੌਰ ਮੇਰਾ ਬ੍ਰਦਰ ਗੁਰਦੀਪ ਸਿੰਘ ਅਤੇ ਉਹਦਾ ਇੱਕ ਬੇਟਾ ਹੈ ਫਤਿਹ ਫਤਿਹ ਸਿੰਘ ਅਤੇ ਇਸੇ ਤਰ੍ਹਾਂ ਹੀ ਮੇਰੇ ਚਾਚਾ ਜੀ ਦੇ ਲੜਕੇ ਵੀ ਸਾਡੇ ਨਾਲ ਹੀ ਰਹਿੰਦੇ ਹੈ ਉਹ ਵੀ ਦੋ ਬ੍ਰਦਰ ਨੇ ਚਾਚਾ ਜੀ ਦੇ ਲੜਕੇ ਜਗਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਜਸਪ੍ਰੀਤ ਸਿੰਘ ਜਿਹੜਾ ਉਹ ਫੌਜ ਦੇ ਵਿੱਚ ਜੋਬ ਕਰਦਾ ਹੈ ਅਤੇ ਉਸ ਦੀ ਵਾਈਫ ਕੁਲਦੀਪ ਕੌਰ ਅਤੇ ਉਹਦਾ ਇੱਕ ਬੇਟਾ ਆ ਛੋਟਾ ਇਸੇ ਤਰ੍ਹਾਂ ਇੱਕ ਜਿਹੜਾ ਸਾਡਾ ਛੋਟਾ ਬ੍ਰਦਰ ਹੈ ਉਹ ਅਸਟਰੀਆ ਦੇ ਵਿੱਚ ਆਪਣਾ ਟ੍ਰਾਂਸਪੋਰਟ ਦਾ ਕੰਮ ਕਰਦਾ ਹੈ ਆ ਉਹ ਅਜੇ ਕੁਵਾਰਾ ਹੈ ਅਤੇ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਤਾਂ ਮੇਰਾ ਜਿਹੜਾ ਫਰੈਂਡ ਸਰਕਲ ਹੈ ਉਹ ਵੀ ਕਾਫੀ ਵੱਡਾ ਹੈ ਕਿਉਂਕਿ ਮੈਂ ਜਰਨਲਿਸਟ ਹੋਣ ਕਰਕੇ ਤਕਰੀਬਨ ਮੇਰੇ ਪੰਜਾਬ ਦੇ ਵਿੱਚ ਫਰੈਂਡ ਹੈਗੇ ਨੇ ਜੇ ਆਪਾਂ ਹੋਰ ਬ ਫਰੈਂਡਾਂ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਬਹੁਤ ਸਾਰਾ ਫਰੈਂਡ ਸਰਕਲ ਹੈਗਾ ਹੈ ਅਤੇ ਜਿਹੜਾ ਪ ਜਿਸ ਤਰ੍ਹਾਂ ਪਰਿਵਾਰ ਵੱਲੋਂ ਪਿਆਰ ਮਿਲਦਾ ਇਸ ਤਰ੍ਹਾਂ ਦੋਸਤਾਂ ਰਿਸ਼ਤੇਦਾਰਾਂ ਵੱਲੋਂ ਵੀ ਭਰਪੂਰ ਜਿਹੜਾ ਪਿਆਰ ਉਹ ਮਿਲਦਾ ਹੈ